ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਸ ਤਰ੍ਹਾਂ ਕਿ ਮੇਰਾ ਪਠਾਨਕੋਟ ਦੇ ਵਿੱਚ ਹੀ ਛੋਟਾ ਜਿਹਾ ਬੁਟੀਕ ਆ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮੇਰੇ ਕੋਲ ਮ ਮਤਲਬ ਕਿ ਗਾਹਕ ਆਉਂਦੇ ਨੇ ਜਿਸ ਤਰ੍ਹਾਂ ਹਰ ਹਰ ਸੂਟ ਦਾ ਮੇਰਾ ਅਲੱਗ ਅਲੱਗ ਰੇਟ ਹੁੰਦਾ ਹੈ ਇਸ ਤਰ੍ਹਾਂ ਜ਼ਿਆਦਾਤਰ ਮੈਂ ਹਰ ਤਰ੍ਹਾਂ ਦੇ ਸੂਟ ਸੀ ਲੈਂਦੀ ਲਹਿੰਗੇ ਫ੍ਰੋਕ ਪਲਾਜੋ ਸਭ ਸਭ ਤਰ੍ਹਾਂ ਦੇ ਸੂਟ ਸੀ ਲੈਂਦੀ ਹਾਂ ਇਹਨਾਂ ਵਿੱਚੋਂ ਜ਼ਿਆਦਾ ਸਿੰਪਲ ਸੂਟ ਸੀਣਾ ਮੈਂ ਜ਼ਿਆਦਾ ਪਸੰਦ ਕਰਦੀ ਹਾਂ ਇਹਨਾਂ ਵਿੱਚੋਂ ਜ਼ਿਆਦਾ ਸੂਟ ਜਿਹੜੇ ਆ ਇਹਨਾਂ ਦੀ ਮਤਲਬ ਕਿ ਸਿੰਪਲ ਸੂਟ ਪਲਾਜੋ ਅਤੇ ਮਤਲਬ ਕਿ ਇਸ ਤਰ੍ਹਾਂ ਦੇ ਸੂਟ ਜਿਹੜਾ ਮੈਂ ਸੀਣਾ ਪਸੰਦ ਕਰਦੀ ਹਾਂ ਜਿਵੇਂ ਕਿ ਸੂਟ ਸੀਂਦੀ ਹਾਂ ਉਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਵਰਕ ਹੋਵੇ ਉਸੇ ਹਿਸਾਬ ਨਾਲ ਮੈਂ ਪੈਸੇ ਲੈ ਲੈਂਦੀ ਹਾਂ ਜਿਸ ਤਰ੍ਹਾਂ ਸਿੰਪਲ ਸੂਟ ਦਾ ਕੋਈ ਦੋ ਸੌ ਰੁਪਈਆ ਸਵਾਈ ਲੈਂਦੇ ਆ ਜ਼ਿਆਦਾ ਜ ਮਹਿੰਗਾ ਸੂਟ ਲਾਈਨਿੰਗ ਵਾਲਾ ਉਹਦੀ ਸੂਟ ਚਾਰ ਸੌ ਪੰਜ ਸੌ ਦੀ ਵੀ ਸਵਾਈ ਹੋ ਜਾਂਦੀ ਆ ਜਿ ਜਿੱਦਾਂ ਪਲਾਜੋ ਵਗੈਰਾ ਉਹਨਾਂ ਦੇ ਉਹਨਾਂ ਦੀ ਚਾਰ ਸੌ ਤੱਕ ਵੀ ਸਵਾਈ ਹੋ ਜਾਂਦੀ ਆ ਹਰ ਤਰ੍ਹਾਂ ਦੇ ਸੂਟਾਂ ਦੀ ਵੱਖ ਵੱਖ ਸਵਾਈ ਹੈ ਪਰ ਜ ਜਿਸ ਤਰ੍ਹਾਂ ਕਿ ਮੈਨੂੰ ਕੋਈ ਚੀਜ਼ ਨਾ ਵੀ ਆਵੇ ਤਾਂ ਮੈਨੂੰ ਤਕਰੀਬਨ ਤਕਰੀਬਨ ਮੈਨੂੰ ਸਾਰਾ ਕੰਮ ਆਉਂਦਾ ਹੀ ਆ ਤਕਰੀਬਨ ਜੇ ਮੈਨੂੰ ਕੋਈ ਕੰਮ ਨਾ ਵੀ ਆਵੇ ਤਾਂ ਮੈਂ ਯੂਟੀਊਬ ਖੋਲ੍ਹ ਲੈਂਦੀ ਹਾਂ ਯੂਟੀਊਬ 'ਤੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਸੀਣੇ ਪੈਂਦੇ ਹਨ ਅਤੇ ਉਹ ਸੀਂਦੇ ਹਨ ਅਤੇ ਉਹਨਾਂ ਤੋਂ ਹੀ ਮੈਂ ਤਰ੍ਹਾਂ ਤਰ੍ਹਾਂ ਦੇ ਕੰਮ ਸਿੱਖ ਲੈਂਦੀ ਹਾਂ